ਮੈਂ ਬੜੀ ਵਾਰੀ ਪੰਛੀਆਂ ਨੂੰ ਦੇਖਿਆ ਓਲੇ ਹੋ ਕੇ ਮੈਨੂੰ ਪੰਛੀ ਬਹੁਤ ਪਸੰਦ ਹਨ ਉਹਨਾਂ ਨੂੰ ਦੇਖਣਾ ਮੈਨੂੰ ਬਹੁਤ ਪਸੰਦ ਹੈ ਇੱਕ ਵਾਰੀ ਮੈਂ ਚਿੜੀਆ ਘਰ ਗਈ ਸੀ ਜਿੱਥੇ ਉੱਥੇ ਪੰਛੀਆਂ ਦੇ ਬਹੁਤ ਪਿੰਜਰੇ ਲੱਗੇ ਹੋਏ ਸਨ ਜਿੱਥੇ ਉਹਨਾਂ ਨੇ ਉਹ ਪਿੰਜਰੇ ਦੇ ਵਿੱਚ ਹੀ ਆਪਣੇ ਝੋਪੜੀਆਂ ਘੋਸਲੇ ਬਣਾਏ ਹੋਏ ਸੀ ਤੇ ਜਦੋਂ ਮੈਂ ਧਿਆਨ ਨਾਲ ਉਹਲੇ ਹੋ ਕੇ ਦੇਖਣ ਦੀ ਕੋਸ਼ਿਸ਼ ਕੀਤੀ ਉਹ ਪੰਛੀ ਮੈਨੂੰ ਦੇਖ ਕੇ ਲੁੱਕ ਗਏ ਤੇ ਥੋੜੇ ਟਾਈਮ ਬਾਅਦ ਬਾਹਰ ਵੀ ਆ ਗਏ ਬਾਹਰ ਆ ਕੇ ਦੇਖਿਆ ਜਦ ਮੈਂ ਉਹਨਾਂ ਨੂੰ ਨੇੜੇ ਹੋ ਕੇ ਦੇਖਿਆ ਮੈਨੂੰ ਬਹੁਤ ਵਧੀਆ ਲੱਗਿਆ